ਅੱਜ ਦੇ ਟਾਈਮ ਵਿੱਚ ਬਿਜਲੀ ਤੋਂ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀ ਅਸੀਂ ਆਪਣੀ ਜ਼ਿੰਦਗੀ 'ਚ ਰੋਜ਼ ਦੇ ਕੰਮ ਕਾਰ ਵਿੱਚ ਉਹਨਾਂ ਦਾ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਦੀ ਸਾਨੂੰ ਬਹੁਤ ਜ਼ਿਆਦਾ ਆਦਤ ਵੀ ਹੋ ਗਈ ਹੈ ਅਤੇ ਉਹਨਾਂ ਬਿਨਾਂ ਅਸੀਂ ਹੁਣ ਕਈ ਲੋਕ ਜਿਹੜੇ ਨੇ ਉਹਨਾਂ 'ਤੇ ਡਿਪੈਂਡ ਬਹੁਤ ਜ਼ਿਆਦਾ ਹੋ ਗਏ ਹਨ ਅਤੇ ਉਹਨਾਂ ਨੂੰ ਯੂਜ਼ ਕਰੇ ਬਿਨਾਂ ਰਹਿ ਵੀ ਨਹੀਂ ਪਾਉਂਦੇ ਜੇ ਬਿਜਲੀ ਦਾ ਕੱਟ ਲੱਗਦਾ ਏ ਤਾਂ ਕਈ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਕਈ ਲੋਕ ਕਹੇ ਸੁਣੇ ਜਾ ਸਕਦੇ ਨੇ ਕਿ ਅੱਜ ਸਾਡਾ ਇਹ ਫਲਾਣਾ ਕੰਮ ਰਹਿ ਗਿਆ ਅੱਜ ਅਸੀਂ ਇਹ ਕੰਮ ਨਹੀਂ ਕਰ ਪਾਏ ਕਿਉਂਕਿ ਲਾਈਟ ਨਹੀਂ ਸੀਗੀ ਪਰ ਮੈਂ ਜਿਹੜੀ ਹਾਂ ਉਹ ਮੈਂ ਜਿੰਨਾਂ ਕੰਮ ਬਿਜਲੀ ਤੋਂ ਕਰਦੀ ਹਾਂ ਉਸ ਤੋਂ ਜ਼ਿਆਦਾ ਮੈਂ ਆਪਣੇ ਹੱਥ ਨਾਲ਼ ਕਰਨ ਵਿੱਚ ਯਕੀਨ ਰੱਖਦੀ ਹਾਂ ਅਤੇ ਮੇਰੇ ਕੋਲ ਬਿਜਲੀ ਨਾਲ਼ ਚੱਲਣ ਵਾਲੀ ਉਪਕਰਨ ਵੀ ਹੈਗੇ ਨੇ ਅਤੇ ਮੇਰੇ ਕੋਲ ਹੱਥ ਨਾਲ ਕਰਨ ਵਾਲੇ ਉਪਕਰਨ ਵੀ ਹੈਗੇ ਨੇ ਜੇ ਬਿਜਲੀ ਨਹੀਂ ਹੁੰਦੀ ਤਾਂ ਮੈਂ ਉਹਨਾਂ ਦਾ ਇਸਤੇਮਾਲ ਕਰ ਲਿੰਦੀ ਹਾਂ ਅਤੇ ਜਿਹੜਾ ਇਨਵਰਟਰ ਹੈ ਉਹ ਅੱਜ ਕੱਲ੍ਹ ਨੱਬੇ ਪ੍ਰਤੀਸ਼ਤ ਜਿਹੜੇ ਘਰ ਨੇ ਉਹਨਾਂ ਵਿੱਚ ਹੈਗਾ ਏ ਅਤੇ ਉਹਦੇ ਬਿਨਾਂ ਹੁਣ ਲੋਕਾਂ ਦਾ ਕੰਮ ਸਰਦਾ ਵੀ ਨਹੀਂ ਏ